ਅਠਾਰ੍ਹਾਂ ਅਪ੍ਰੈਲ ਦੋ ਹਜ਼ਾਰ ਬਾਈ ਤੇਈ ਮਾਰਚ ਦੋ ਹਜ਼ਾਰ ਇੱਕ ਤੀਹ ਜੁਲਾਈ ਦੋ ਹਜ਼ਾਰ ਚਾਰ ਅਠਾਰ੍ਹਾਂ ਜੂਨ ਉੱਨੀ ਸੌ ਨੜਿਨਵੇਂ ਅਠਾਈ ਸਪਤੰਬਰ ਉੱਨੀ ਸੌ ਪਚਾਨਵੇਂ